ਇੱਕ ਜਨਵਰੀ ਦੋ ਹਜ਼ਾਰ ਇੱਕ ਪੱਚੀ ਅਗਸਤ ਦੋ ਹਜ਼ਾਰ ਇੱਕ ਪੱਚੀ ਅਕਤੂਬਰ ਉੱਨੀ ਸੌ ਪੰਝੱਤਰ ਤੀਹ ਦਸੰਬਰ ਉੱਨੀ ਸੌ ਨੜਿਨਵੇਂ ਚਾਰ ਅਕਤੂਬਰ ਦੋ ਹਜ਼ਾਰ ਸਤਾਰ੍ਹਾਂ